ਹਾਂਜੀ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਭਾਅ ਜੀ ਗੁਰਦਾਸਪੁਰ ਤੋਂ ਬੋਲ ਰਹੇ ਸੀ ਹਾਂਜੀ ਹਾਂਜੀ ਹਾਂ ਜੀ ਭਾਅ ਜੀ ਤੁਹਾਡੇ ਨਾ ਢਾਬੇ ਤੋਂ ਓਡਰ ਕੀਤਾ ਸੀ ਪੰਜਾਬੀ ਢਾਬਾ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਉਹ ਮੈਨੂੰ ਨਾ ਵੈਸੇ ਨਾ ਮੇਰੇ ਦੋਸਤਾਂ ਨੇ ਦੱਸਿਆ ਸੀ ਕਿ ਨਵਾਂ ਢਾਬਾ ਖੁੱਲ੍ਹਿਆ ਸ਼ਹਿਰ ਵਿੱਚ ਅਤੇ ਇੱਕ ਵਾਰੀ ਓਡਰ ਕਰਕੇ ਦੇਖਣਾ ਚਾਹੀਦਾ ਕਿ ਸਮਾਨ ਬਹੁਤ ਵਧੀਆ ਬਣਾਉਂਦੇ ਉਹ ਅਤੇ ਮੈਂ ਕਿਹਾ ਚੱਲ ਇੱਕ ਵਾਰੀ ਟਰਾਈ ਕਰਕੇ ਦੇਖ ਲੈਂਦੇ ਹਾਂ ਹਾਂਜੀ ਹਾਂਜੀ ਹਾਂਜੀ ਸਵੇਰ ਦੀ ਗੱਲ ਹੈ ਹਾਂਜੀ ਹਾਂਜੀ ਮੈਂ ਸਵੇਰੇ ਫਿਰ ਤੁਹਾਨੂੰ ਨਾ ਫੋਨ ਕੀਤਾ ਸੀ ਪਹਿਲਾ ਹੀ ਕਿ ਸਾਡੇ ਪੰਜ ਛੇ ਜਾਣਿਆਂ ਦਾ ਖਾਣਾ ਚਾਹੀਦਾ ਸੀ ਇੱਥੇ ਤਾਂ ਮੈਂ ਦੱਸਤਾ ਸੀ ਖਾਣਾ ਪਰੌਂਠੇ ਚਾਹੀਦੇ ਨੇ ਲੱਸੀ ਦੇ ਗਲਾਸ ਚਾਹੀਦੇ ਨੇ ਸਬਜ਼ੀ ਚਾਹੀਦੀ ਹੈ ਪਨੀਰ ਚਾਹੀਦਾ ਹੈ ਹਾਂਜੀ ਹਾਂਜੀ ਹਾਂਜੀ ਭਾਅ ਜੀ ਅਤੇ ਉਹ ਪ੍ਰੋਬਲਮ ਹੋ ਗਈ ਸੀਗੀ ਮੈਂ ਤੁਹਾਨੂੰ ਉਸ ਵਕਤ ਕਿਹਾ ਸੀ ਕਿ ਓਡਰ ਜਲਦੀ ਤੋਂ ਜਲਦੀ ਪਹੁੰਚਾਇਆ ਜਾਵੇ ਪਰ ਪ੍ਰੋਬਲਮ ਇਹ ਹੋ ਗਈ ਵੀ ਮੈਂ ਤੁਹਾਨੂੰ ਨਾਲੇ ਕਿਹਾ ਸੀ ਕਿ ਕਿਊ ਆਰ ਕੋਡ ਭੇਜ ਦਿੱਤਾ ਜਾਵੇ ਮੈਨੂੰ ਕਿਉਂਕਿ ਕਿ ਮੇਰੇ ਕੋਲ ਨਾ ਉਹ ਨਹੀਂ ਸੀ ਹੈਗਾ ਪੇਮੈਂਟ ਕੈਸ਼ ਡਿਲੀਵਰੀ ਕਰਨ ਦਾ ਕੋਈ ਸਾਧਨ ਨਹੀਂ ਸੀ ਹੈਗਾ ਅਤੇ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੂੰ ਕਿਊ ਆਰ ਕੋਡ ਵੀ ਨਾਲ ਦਿੱਤਾ ਜਾਵੇ ਹਾਂਜੀ ਹਾਂਜੀ ਹਾਂਜੀ ਪਰ ਉਹ ਹੋਇਆ ਕੀ ਮੈਨੂੰ ਕਿਊ ਆਰ ਕੋਡ ਤੁਸੀਂ ਦਿੱਤਾ ਉਹ ਵਰਕ ਨਹੀਂ ਕੀਤਾ ਫਿਰ ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਫੋਨ ਕੀਤਾ ਸੀ ਕਿ ਮੈਨੂੰ ਕਿਊ ਆਰ ਕੋਡ ਵਰਕ ਨਹੀਂ ਕਰ ਰਿਹਾ ਮੈਨੂੰ ਯੂ ਪੀ ਆਈ ਆਈ ਡੀ ਦੇ ਦਿਓ ਕੋਈ ਹੋਰ ਅਤੇ ਤੁਸੀਂ ਫਿਰ ਕੋਈ ਹੋਰ ਯੂ ਪੀ ਆਈ ਡੀ ਦਿੱਤੀ ਹਾਂਜੀ ਉਸ 'ਤੇ ਵੀ ਦੋ ਦਿਨ ਟਰਾਈ ਕਰਨ ਤੋਂ ਬਾਅਦ ਫਿਰ ਪੇਮੈਂਟ ਹੋ ਹੀ ਗਈ ਸੀ ਹਾਂਜੀ ਹਾਂਜੀ ਤਿੰਨ ਹਜ਼ਾਰ ਦੋ ਸੌ ਵੀਹ ਰੁਪਏ ਕੀਤੇ ਸੀ ਭਾਅ ਜੀ ਹਾਂਜੀ ਹਾਂਜੀ ਤਿੰਨ ਹਜ਼ਾਰ ਦੋ ਸੌ ਵੀਹ ਰੁਪਏ ਕਰ ਦਿੱਤੇ ਸੀ ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਫਿਰ ਇੱਕ ਵਾਰੀ ਯਾਦ ਦਿਵਾ ਦਿਲਾ ਸੀ ਕਿ ਖਾਣਾ ਜਲਦੀ ਤੋਂ ਜਲਦੀ ਪਹੁੰਚਾਇਆ ਜਾਵੇ ਕਿਉਂਕਿ ਪ੍ਰੋਗਰਾਮ ਸੈਟ ਸੀ ਪੂਰਾ ਰਿਸ਼ਤੇਦਾਰ ਵੀ ਆਏ ਹੋਏ ਸੀ ਘਰ ਹਾਂਜੀ ਅਤੇ ਉਹ ਫਿਰ ਹੋਇਆ ਕੀ ਓਹ ਹੁਣ ਪੰਦਰਾਂ ਕੁ ਮਿੰਟ ਦੀ ਗੱਲ ਹੈ ਮਤਲਬ ਓਡਰ ਕਰਨ ਤੋਂ ਬਾਅਦ ਇੱਕ ਡੇਢ ਘੰਟਾ ਹੋ ਗਿਆ ਓਡਰ ਨੂੰ ਆਉਂਦੇ ਹਾਂਜੀ ਹਾਂਜੀ ਭਾਅ ਜੀ ਇੱਕ ਡੇਢ ਘੰਟਾ ਹੋ ਗਿਆ ਅਤੇ ਓਹ ਓਡਰ ਬਹੁਤ ਲੇਟ ਹੋ ਗਿਆ ਅਤੇ ਇਸ ਵਕਤ ਫਿਰ ਮੈਂ ਫਿਰ ਹੁਣ ਘਰ ਐਮਰਜੈਂਸੀ ਪੈ ਗਈ ਕੋਈ ਬਾਹਰ ਜਾਣ ਦੀ ਅਤੇ ਇਸ ਵਕਤ ਘਰ ਵਿੱਚ ਕੋਈ ਹੈ ਵੀ ਨਹੀਂ ਕਿ ਜੋ ਓਡਰ ਪਿੱਕ ਕਰ ਸਕੇ ਹਾਂਜੀ ਹਾਂਜੀ ਹਾਂਜੀ ਇਸ ਗੱਲ ਦੀ ਮੁਆਫੀ ਮੰਗਦਾ ਵੈਸੇ ਮੈਂ ਪਰ ਇਸ ਵਕਤ ਘਰ ਕੋਈ ਹੈ ਨਹੀਂ ਸੀ ਔਡਰ ਫਿਰ ਪਿਕ ਨਹੀਂ ਕਰ ਸਕਦੇ ਅਤੇ ਹੁਣ ਸਾਰੇ ਜਣੇ ਫਿਰ ਘਰੋਂ ਬਾਹਰ ਆਏ ਹੋਏ ਨੇ ਰਿਸ਼ਤੇਦਾਰ ਵੀ ਫਿਰ ਚਲੇ ਗਏ ਘਰਾਂ ਨੂੰ ਆਪਣੇ ਆਪਣੇ ਹਾਂਜੀ ਹਾਂਜੀ ਵੈਸੇ ਵੈਸੇ ਸੋਚਿਆ ਸੀ ਕਿ ਇੱਕ ਵਾਰੀ ਔਡਰ ਕਰਕੇ ਦੇਖ ਲੈਂਦੇ ਹਾਂ ਅਤੇ ਵਧੀਆ ਖਾਣਾ ਲੱਗੂਗਾ ਅਤੇ ਫਿਰ ਮੰਗਾਵਾਂਗੇ ਹਾਂਜੀ ਅਸੀਂ ਹਾਂਜੀ ਹਾਂਜੀ ਭਾਅ ਜੀ ਹਾਂਜੀ ਭਾਅ ਜੀ ਇਸ ਲਈ ਫਿਰ ਮੈਂ ਕਹਿਣਾ ਚਾਹੁੰਦਾ ਕਿ ਔਡਰ ਨੂੰ ਰੱਦ ਕੀਤਾ ਜਾਵੇ ਹੁਣ ਹੁਣ ਦੇ ਲਈ ਔਡਰ ਰੱਦ ਕਰ ਦਿਓ ਫਿਰ ਕਿਸ ਅਤੇ ਪੇਮੈਂਟ ਜਿਹੜੀ ਮੈਂ ਤੁਹਾਨੂੰ ਕੀਤੀ ਸੀ ਹਾਂਜੀ ਹਾਂਜੀ ਉਹ ਪੇਮੈਂਟ ਮੇਰੇ ਅਕਾਊਂਟ ਵਿੱਚ ਵਾਪਸ ਭੇਜ ਦਿੱਤੇ ਜਾਣ ਪੈਸੇ ਹਾਂਜੀ ਹਾਂਜੀ ਭਾਅ ਜੀ ਉਹ ਫਿਰ ਔਡਰ ਕੈਂਸਲ ਕਰਨਾ ਪੈ ਰਿਹਾ ਨਾ ਹੁਣ ਅਤੇ ਇਸ ਲਈ ਤੁਹਾਨੂੰ ਬੇਨਤੀ ਕਰਦਾ ਕਿ ਮੇਰੀ ਪੇਮੈਂਟ ਵਾਪਸ ਕੀਤੀ ਜਾਵੇ ਮੇਰੇ ਅਕਾਊਂਟ ਵਿੱਚ ਬਾਕੀ ਫਿਰ ਕਦੀ ਦੇਖਾਂਗੇ ਫਿਰ ਔਡਰ ਕਰਾਂਗੇ ਕੋਈ ਦਿਨ ਹਾਂਜੀ ਜ਼ਰੂਰ ਜ਼ਰੂਰ ਜ਼ਰੂਰ ਔਡਰ ਕਰਾਂਗੇ ਤੁਹਾਡੇ ਢਾਬੇ ਤੋਂ ਹਾਂਜੀ ਭਾਅ ਜੀ ਥੈਂਕ ਯੂ ਭਾਅ ਜੀ ਥੈਂਕ ਯੂ